ਜੇ ਸ਼ਾਸਤਰੀ ਸੰਗੀਤ ਜਾਂ ਸਮਕਾਲੀ ਗੀਤ ਸੰਗੀਤ ਦਾ ਮੁਕਾਬਲਾ ਦੇਖਿਆ ਜਾਵੇ ਤਾਂ ਇਹਨਾਂ ਵਿੱਚ ਕਿਹੜਾ ਮੁਸ਼ਕਲ ਹੈ ਅਤੇ ਕਿਹੜਾ ਆਸਾਨ ਹੈ ਸਭ ਤੋਂ ਮੁਸ਼ਕਲ ਸ਼ਾਸਤਰੀ ਸੰਗੀਤ ਹੈ ਜਾਂ ਸਮ ਸਮਕਾਲੀ ਸਮਕਾਲੀ ਬਹੁਤ ਘੱਟ ਮੁਸ਼ਕਲ ਵਾਲਾ ਹੈ ਵੈਸੇ ਤੋ ਇਹਨਾਂ ਦੀ ਤੁਲਨਾ ਕੀਤੀ ਕਰਨੇ ਵਾਸਤੇ ਅਭਿਆਸ ਕ ਅਭਿਆਸ ਕਰਨਾ ਮੁਸ਼ਕਲ ਵੀ ਨਹੀਂ ਹੈ ਅਤੇ ਸਭ ਠੀਕ ਠਾਕ ਹੈ ਇਸ ਲਈ ਸਮਕਾਲੀ ਸੰਗੀਤ ਚੰਗੀ ਤਰ੍ਹਾਂ ਸੌਖਾ ਤਰੀਕਾ ਮੰਨਿਆ ਗਿਆ ਹੈ ਧੰਨਵਾਦ ਜੀ